ਸਾਡੇ ਅਸਥਾਨ 'ਤੇ ਮੂਲ ਕਲਾ ਰੂਪ ਜਾਂ ਸ਼ਿਲਪਕਾਰੀ ਕੀ ਹਨ ਅਤੇ ਉਹ ਹੋਰ ਸਥਾਨਾਂ 'ਤੇ ਕਲਾ ਰੂਪਾਂ ਤੋਂ ਕਿਵੇਂ ਵੱਖਰੀ ਹੈ ਸਾਡੇ ਸਥਾਨ 'ਤੇ ਮੂਲ ਕਲਾ ਪੇਂਟਿੰਗ ਹੈ ਇਹ ਸ਼ਿਲਪਕਾਰੀ ਸਾਡੇ ਹੋਰ ਹੋਰ ਸਥਾ ਸਥਾਨਾਂ ਤੋਂ ਕਲਾ ਰੂਪ ਤੋਂ ਬਹੁਤ ਜ਼ਿਆਦਾ ਵੱਖਰੀ ਹੈ ਜਿਵੇਂ ਕਿ ਪੇਂਟਿੰਗ ਕੱਪੜਿਆਂ 'ਤੇ ਸੂਟਾਂ 'ਤੇ ਚਾਦਰਾਂ 'ਤੇ ਸਿਰਹਾਣਿਆਂ 'ਤੇ ਰਜਾਈਆਂ 'ਤੇ ਬਹੁਤ ਜ਼ਿਆਦਾ ਹੋਰ ਤਰੀਕਿਆਂ 'ਤੇ ਕੀਤੀ ਜਾਂਦੀ ਹੈ ਪੇਂਟਿੰਗ ਨਾਲ ਬਹੁਤ ਜ਼ਿਆਦਾ ਆਰਥਿਕ ਤਰੱਕੀ ਵੀ ਹੁੰਦੀ ਹੈ ਪੇਂਟਿੰਗ ਕਰਕੇ ਲੋਕ ਕੱਪੜੇ ਸੂਟ ਚਾਦਰਾਂ ਸਿਰਹਾਣੇ ਵੇਚਦੇ ਹਨ ਅਤੇ ਆਰਥਿਕ ਤੌਰ 'ਤੇ ਆਪਣੀ ਆਰਥਿਕ ਤੰਗੀ ਨੂੰ ਦੂਰ ਕਰਦੇ ਹਨ ਪੇਂਟਿੰਗ ਬਹੁਤ ਜ਼ਿਆਦਾ ਵੱਖਰੀ ਤੌਰ 'ਤੇ ਹੈ ਬਾਕੀ ਸਾਰੇ ਵੀ ਆਪਣੇ ਆਪਣੇ ਆਪਣੇ ਆਪਣੇ ਸਥਾਨ 'ਤੇ ਬਹੁਤ ਜ਼ਿਆਦਾ ਪ੍ਰਭਾਵਿਤ ਹਨ ਅਤੇ ਵੱਖਰੇ ਹਨ ਪਰ ਪੇਂਟਿੰਗ ਸਾਡੇ ਸਾਡੇ ਸਥਾਨ 'ਤੇ ਬਹੁਤ ਹੀ ਮੁੱਖ ਰੂਪ ਵਿੱਚ ਸ ਸਹਾਇਕ ਹੈ ਮਦਦ ਕਰਦੀ ਹੈ ਅਤੇ ਬਹੁਤ ਹੀ ਜ਼ਿਆਦਾ ਵਧੀਆ ਅਤੇ ਬਹੁਤ ਹੀ ਸਟੀਕ ਅਤੇ ਬਹੁਤ ਹੀ ਸੁੰਦਰ ਤਰੀਕਾ ਹੈ ਪੇਂਟਿੰਗ ਸਾਡੇ ਸਥਾਨ 'ਤੇ ਬਹੁਤ ਹੀ ਵੱਖਰੀ ਅਤੇ ਆਪਣੇ ਸ ਆਪਣੇ ਸਥਾਨ 'ਤੇ ਬਹੁਤ ਹੀ ਜ਼ਿਆਦਾ ਪ੍ਰਫੁਲਿਤ ਹੈ ਸਾਡੇ ਸਥਾਨ 'ਤੇ ਪੇਂਟਿੰਗ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਹਰ ਇੱਕ ਘਰ ਵਿੱਚ ਪੇਂਟਿੰਗ ਦਾ ਬਹੁਤ ਹੀ ਵਧੀਆ ਮੂਲ ਅਤੇ ਸ ਸਥੂਲ ਸਥੂਲ ਅਤੇ ਸਟੀਕ ਤਰੀਕਾ ਵਰਤਿਆ ਜਾਂਦਾ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਪੇਂਟਿੰਗ ਕੀਤੀ ਜਾਂਦੀ ਹੈ